ਹੈਲੋ ਹਾਂਜੀ ਹਾਂਜੀ ਬੋਲੋ ਮੇਰਾ ਨਾਮ ਅਮਨ ਹੈ ਮੈਂ ਡੀ ਸੀ ਔਫਿਸ ਦੀ ਇੰਚਾਰਜ ਬੋਲ ਰਹੀ ਹਾਂ ਦੱਸੋ ਕੀ ਸਮੱਸਿਆ ਹਾਂਜੀ ਹਾਂਜੀ ਅੱਛਾ ਤੁਸੀਂ ਜਦੋਂ ਪਹਿਲਾਂ ਡਿਗਰੀ ਲੈਣ ਲਈ ਅਪਲਾਈ ਕੀਤਾ ਸੀ ਤਾਂ ਤੁਸੀਂ ਕਿਹੜੇ ਕਿਹੜੇ ਡਾਕੂਮੈਂਟਸ ਉੱਥੇ ਸਬਮਿਟ ਕੀਤੇ ਸੀ ਅੱਛਾ ਤੇ ਤੁਹਾਨੂੰ ਛੇ ਸਮੈਸਟਰ ਦੀ ਮਾਰਸ਼ੀਟ ਦੇ ਨਾਲ ਨਾਲ ਆਪਣਾ ਆਧਾਰ ਕਾਰਡ ਪੈਨ ਕਾਰਡ ਅਤੇ ਜਦੋਂ ਤੁਸੀਂ ਉੱਥੋਂ ਯੂਨੀਵਰਸਿਟੀ ਤੋਂ ਐਗਜਿਟ ਲਿਆ ਹੋਣਾ ਤਾਂ ਉਸ ਟਾਈਮ ਤੁਸੀਂ ਨੋ ਡਿਊਸ ਦੇ ਫੋਰਮ ਫਿਲ ਕੀਤੇ ਹੋਣਗੇ ਅਤੇ ਤੁਹਾਨੂੰ ਆਪਣੀ ਡਿਗਰੀ ਲੈਣ ਲਈ ਆਧਾਰ ਕਾਰਡ ਪੈਨ ਕਾਰਡ ਅਤੇ ਨੋ ਡਿਊਸ ਦੇ ਫੋਰਮ ਵੀ ਸਬਮਿਟ ਕਰਨੇ ਪੈਣਗੇ

ਅੱਛਾ ਦੇਖੋ ਜਿਹੜਾ ਤੁਹਾਡੇ ਛੇ ਸਮੈਸਟਰ ਦੇ ਮਾਰਕਸ਼ੀਟ ਦੇ ਉੱਪਰ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਉੱਪਰ ਫ਼ੋਨ ਨੰਬਰ ਹੈ ਉਹੀ ਫ਼ੋਨ ਨੰਬਰ ਉਸ 'ਤੇ ਚੱਲੇਗਾ ਅਦਰਵਾਈਜ ਤੁਹਾਨੂੰ ਡਿਗਰੀ ਅਲੋਟ ਨਹੀਂ ਹੋਵੇਗੀ ਤਾਂ ਜਿਹੜਾ ਤੁਹਾਡਾ ਪਹਿਲਾਂ ਵਾਲਾ ਆਧਾਰ ਕਾਰਡ ਹੈ ਉਸ ਨੂੰ ਹੀ ਤੁਸੀਂ ਸਬਮਿਟ ਕਰਨਾ ਹੈ ਨਹੀਂ ਨਹੀਂ ਨਹੀਂ ਬਸ ਆਧਾਰ ਕਾਰਡ ਪੈਨ ਕਾਰਡ ਅਤੇ ਤੁਹਾਡਾ ਨੋ ਡਿਊਸ ਦਾ ਫੋਰਮ ਅਤੇ ਜੇਕਰ ਤੁਸੀਂ ਹੋਸਟਲਰ ਸੀਗੇ ਤਾਂ ਆਪਣੇ ਹੋਸਟਲ ਦਾ ਵੀ ਨੋ ਡਿਊਸ ਫੋਰਮ ਸਬਮਿਟ ਕਰਨਾ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਡਿਗਰੀ ਦੀ ਪ੍ਰਾਪਤੀ ਹੋ ਸਕੇ

ਕਿਵੇਂ ਤੁਹਾਡੀ ਆਵਾਜ਼ ਨਹੀਂ ਆ ਰਹੀ ਹਾਂਜੀ ਡਿਗਰੀ ਕੋਰੀਅਰ ਹੋ ਜਾਊਗੀ ਸਾਰੇ ਡਾਕੂਮੈਂਟਸ ਟਾਈਮ ਸਿਰ ਸਬਮਿਟ ਕਰ ਦਿਓ ਹਾਂਜੀ ਠੀਕ ਹੈ ਜੀ